ਫਸਲ ਦਾ ਅਲੱਗ ਅਲੱਗ ਟਾਈਮ ਹੁੰਦਾ ਬੀਜਣ ਦਾ ਜਿਵੇਂ ਗਰਮੀਆਂ ਨੂੰ ਫਸਲ ਬੀਜਣੀ ਜਿਵੇਂ ਗਰਮੀਆਂ ਨੂੰ ਜ਼ੀਰੀ ਲਗਾ ਦਿੱਤੀ ਝੋਨਾ ਲਾਇਆ ਕਣਕ ਬੀਜੀ ਆਪਾਂ ਨੇ ਠੀਕ ਹੈ ਸੂਰਜਮੁਖੀ ਬੀਜੀ ਜੀ ਇਹ ਗਰਮੀਆਂ ਨੂੰ ਬੀਜ ਦਿੱਤੀ ਸਿਆਲ ਨੂੰ ਆਪਾਂ ਮੱਕੀ ਬੀਜਦੇ ਛੋਲੇ ਬੀਜ ਦਿੰਦੇ ਛੋਲੇ ਬੀਜਦੇ ਮੱਕੀ ਬੀਜਦੇ ਅਤੇ ਆਪਾਂ ਤਿਲ ਵਗੈਰਾ ਗਰਮੀਆਂ ਸਿਆਲ ਨੂੰ ਬੀਜਦੇ ਅਲੱਗ ਅਲੱਗ ਫਸਲਾਂ ਦਾ ਅਲੱਗ ਅਲੱਗ ਆਲੂ ਲਗਾ ਦਿੱਤੇ ਜੀ ਗਰਮੀਆਂ ਨੂੰ ਅਤੇ ਹੋਰ ਜਿਹੜੀਆਂ ਜਿਹੜੀਆਂ ਫਸਲਾਂ ਆਪਣੇ ਆਪਣੇ ਟਾਈਮ ਨਾਲ ਬੀਜੀਆਂ ਜਾਂਦੀਆਂ ਫਸਲਾਂ ਦਾ ਵੀ ਟਾਈਮ ਹੁੰਦਾ ਬੀਜਣ ਦਾ